ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਇੱਥੇ ਇੱਦਾਂ ਨਾ ਦਰਬਾਰ ਸਾਹਿਬ ਮੱਥਾ ਟੇਕੋਗੇ ਨਾ ਮੱਥਾ ਟੇਕ ਕੇ ਬਾਹਰ ਆਓਗੇ ਅਤੇ ਉੱਥੇ ਸਰਾਂ ਦੇ ਬਾਹਰ ਨਾ ਇੱਕ ਬੱਸ ਖੜ੍ਹੀ ਹੁੰਦੀ ਆ ਉਹ ਆਪਣਾ ਫਰੀ ਜਾਂਦੀ ਹੈ ਉਹ ਜਿੰਨੇ ਅਲੱਗ ਅਲੱਗ ਗੁਰਦੁਆਰੇ ਹੈਗੇ ਨੇ ਨਾ ਬਾ ਬਾਬਾ ਬਕਾਲਾ ਇੱਧਰ ਬਾਬੇ ਬੁੱਢੇ ਦੀ ਬੀੜ ਕੱਥੂ ਨੰਗਲ ਗੁਰੂ ਬਾਬਾ ਬੁੱਢੇ ਦਾ ਗੁਰਦੁਆਰਾ ਰਾਮਦਾਸ ਅਤੇ ਹੋਰ ਵੀ ਹੈਗਾ ਬੱਸ ਦੇ ਟਾਈਮ ਵੀ ਹੈਗੇ ਆਪਣਾ ਸਵੇਰੇ ਜਾਂਦੀ ਆਪਣਾ ਸਾਢੇ ਅੱਠ ਵਾਪਸ ਉਹ ਸ਼ਾਮ ਨੂੰ ਆ ਜਾਂਦੀ ਹੈ ਪ ਪੰਜ ਛ ਛੇ ਵਜੇ ਸਾਢੇ ਪੰਜ ਛੇ ਵਜੇ ਵਾਪਸ ਆ ਜਾਂਦੀ ਆ ਉਹ ਸਾਰੇ ਗੁਰਦੁਆਰੇ ਨਾ ਆਪਣਾ ਦਰਸ਼ਨ ਆਰਾਮ ਨਾਲ ਕਰ ਸਕਦੇ ਹਾਂ ਬੱਸ 'ਚ ਔਖਾ ਹੁੰਦਾ ਨਾ ਬੱਸਾਂ ਬੁੱਸਾਂ ਚੜ੍ਹਨਾ ਇਕੱਲੇ ਵਾ ਬੰਦੇ ਵਾ ਵਾਸਤੇ ਔਖਾ ਹੁੰਦਾ ਅਤੇ ਸ ਉੱਥੇ ਇਕੱਠੇ ਬੰਦੇ ਹੁੰਦੇ ਸਾਰੇ ਕੋਈ ਰਾਹ 'ਚ ਤਕਲੀਫ ਹੀ ਹੋ ਜੇ ਅਤੇ ਉਹ ਸਾਂਭ ਲੈਂਦੇ ਨੇ ਅਤੇ ਉਸਦੇ ਆਪਣੇ ਨਾ ਇਹ ਬੰਦਾ ਫਾਇਦੇਮੰਦ ਰਹੇ ਸੀਨੀਅਰ ਸਿਟੀਜਨ ਨੂੰ ਇਹ ਤੁਸੀਂ ਇੱਦਾਂ ਕਰ ਸਕਦੇ ਹੋ ਠੀਕ ਹੈ ਠੀਕ ਹੈ